ਅਤੇ ਹੈਲੋ ਸਰ ਅੱਜ ਮੈਂ ਤੁਹਾਡੇ ਰੈਸਟੋਰੈਂਟ ਦੀ ਐਡ ਦੇਖੀ ਸੀ ਆਪਣੇ ਫੋਨ 'ਤੇ ਅਤੇ ਜਿਹੜੇ ਤੁਹਾਡੀ ਅੱਜ ਦੀ ਸਪੈਸ਼ਲ ਡਿਸ਼ ਹੈ ਮੈਂ ਉਹਨੂੰ ਔਡਰ ਕਰਨਾ ਚਾਹੁੰਦੀ ਹਾਂ ਅਤੇ ਮੇਰੇ ਘਰ ਵਿੱਚ ਫੰਕਸ਼ਨ ਵੀ ਹੈਗਾ ਵਾ ਦੋ ਚਾਰ ਦਿਨਾਂ ਤੱਕ ਅਤੇ ਮੈਂ ਤੁਹਾਡੇ ਜਿਹੜਾ ਰੈਸਟੋਰੈਂਟ ਆ ਉਹ 'ਚੋਂ ਪਹਿਲਾਂ ਵੀ ਖਾਣਾ ਜਿਹੜਾ ਔਡਰ ਕੀਤਾ ਹੋਇਆ ਵਾ ਅਤੇ ਮੈਨੂੰ ਜਿਹੜਾ ਤੁਹਾਡੇ ਰੈਸਟੋਰੈਂਟ ਦਾ ਫੂਡ ਆ ਉਹ ਕਾਫੀ ਅੱਛਾ ਲੱਗਦਾ ਹੈ ਅਤੇ ਤੁਹਾਡੇ ਰੈਸਟੋਰੈਂਟ ਦਾ ਜਿਹੜਾ ਹੈਗਾ ਖਾਣੇ 'ਤੇ ਜਿਹੜਾ ਡਿਸਕਾਊਂਟ ਹੈਗਾ ਵਾ ਉਹ ਸਿਰਫ਼ ਅੱਜ ਦੀ ਡਿਸ਼ 'ਤੇ ਹੈਗਾ ਜਿਹੜੀ ਸ਼ਪੈਸਲ ਡਿਸ਼ ਹੈ ਤੁਹਾਡੀ ਹੈ ਉਹਦੇ 'ਤੇ ਹੀ ਹੈਗਾ ਵਾ ਕਿ ਜਿਹੜੀ ਆ ਹੋਰ ਵੀ ਤੁਹਾਡਾ ਮੈਨਿਊ ਦੱਸਿਆ ਹੋਇਆ ਵਾ ਔਨਲਾਈਨ ਦੇ ਵਿੱਚ ਸ਼ੋ ਹੋ ਰਿਹਾ ਅਤੇ ਉਹਦੇ 'ਤੇ ਵੀ ਕੋਈ ਔਡਰ ਹੈਗਾ ਵਾ ਅਤੇ ਮੈਨੂੰ ਸਾਰੀ ਆਪਣੀ ਰੈਸਟੋਰੈਂਟ ਦੀ ਜਿਹੜੀ ਡਿਟੇਲ ਆ ਅੱਜ ਦਾ ਔਫਰ ਸਾਰੇ ਮੈਨੂੰ ਮੇਰੇ ਫੋਨ 'ਤੇ ਸੈਂਡ ਕਰ ਦਿਉ ਅਤੇ ਤਾਂ ਜੋ ਮੈਂ ਤੁਹਾਡੇ ਰੈਸਟੋਰੈਂਟ ਤੋਂ ਫੂਡ ਜਿਹੜਾ ਔਡਰ ਕਰ ਸਕਾਂ ਅਤੇ ਜਦੋਂ ਤੁਸੀਂ ਮੈਨੂੰ ਸਾਰਾ ਆਪਣਾ ਮੈਨਿਊ ਜਿਹੜਾ ਸੈਂਡ ਕਰ ਦਉਂਗੇ ਅਤੇ ਮੈਂ ਉਸ ਹਿਸਾਬ ਨਾਲ ਜਿਹੜਾ ਮੇਰਾ ਪ੍ਰੋਗਰਾਮ ਹੈ ਮੈਂ ਤੁਹਾਨੂੰ ਡਿਸ਼ਿਜ਼ ਦੱਸ ਦੂੰਗੀ ਅਤੇ ਐਡਰੈਸ ਦੇ ਦੂੰਗੀ ਅਤੇ ਜਿੱਦਣ ਪ੍ਰੋਗਰਾਮ ਹੋਏਗਾ ਤੁਸੀਂ ਉੱਦਣ ਮੈਨੂੰ ਸੈਂਡ ਸਾਰਾ ਖਾਣਾ ਜਿਹੜਾ ਆਪਣੇ ਜਿਹੜੇ ਵਰਕਰ ਹੁੰਦੇ ਉਹਨਾਂ ਦੇ ਹੱਥ ਵਿੱਚ ਭਿਜਵਾ ਦੇਣਾ ਘਰ